ਪਕਵਾਨ ਤਾਂ ਘਰ ਵਿੱਚ ਬਹੁਤ ਆਮ ਬਣਦੇ ਨੇ ਪਰ ਜੇ ਪਰਿਵਾਰ ਵਿੱਚ ਕੋਈ ਬੰਦਾ ਬਿਮਾਰ ਹੋ ਜਾਵੇ ਉਹਨਾਂ ਲਈ ਅੱਜ ਕੱਲ੍ਹ ਜ਼ਿਆਦਾ ਤਾਂ ਖਿਚੜੀ ਜਾਂ ਦਲੀਆ ਹੀ ਚਲਦਾ ਆ ਜਿਵੇਂ ਕਿ ਆਪਾਂ ਉਦਾਹਰਨ ਲੈਂਦੇ ਵੀ ਸਾਡੇ ਘਰ ਜੇ ਕੋਈ ਬਜ਼ੁਰਗ ਸਿਆਣਾ ਬਿਮਾਰ ਆ ਤਾਂ ਆਪਾਂ ਉਹਨੂੰ ਖਿਚੜੀ ਦਿੰਦੇ ਹਾਂ ਕਿਉਂਕਿ ਹਲਕੀ ਹੁੰਦੀ ਆ ਪਚਦੀ ਜਲਦੀ ਆ ਔਰ ਉਹਨਾਂ ਮਤਲਬ ਕਿ ਬਣਾਉਣਾ ਵੀ ਸੌਖਾ ਆ ਥੋੜ੍ਹਾ ਸਪਾਇਸੀ ਨਾ ਬਣਾਵੇ ਹਲਕਾ ਫੁਲਕਾ ਮਸਾਲੇ ਪਾ ਕੇ ਬਣਾਵੇ ਦਲੀਆ ਦਲੀਆ ਜੇ ਬਣਾਉਣਾ ਆ ਆਪਾਂ ਵੈਸੇ ਦਲੀਆ ਖਾਂਦੇ ਹਾਂ ਤਾਂ ਆਪਾਂ ਦੁੱਧ ਵਿੱਚ ਵੀ ਉਹਨੂੰ ਬਣਾ ਸਕਦੇ ਹਾਂ ਕਰ ਸਕਦੇ ਹਾਂ ਪਰ ਜੇ ਆਪਣੇ ਕੋਈ ਬਿਮਾਰ ਆ ਤਾਂ ਆਪਾਂ ਨੂੰ ਉਹਨੂੰ ਪਾਣੀ ਦੇ ਵਿੱਚ ਹੀ ਕਰਨਾ ਚਾਹੀਦਾ ਕਿਉਂਕਿ ਜਦ ਪਾਣੀ ਵਿੱਚ ਆਪਾਂ ਉਹਨੂੰ ਬਣਾਉਂਦੇ ਹਾਂ ਪਕਾਉਂਦੇ ਹਾਂ ਕਰਦੇ ਹਾਂ ਤਾਂ ਉਹ ਹਲਕਾ ਹੁੰਦਾ ਭਾਰਾਪਨ ਮਹਿਸੂਸ ਨਹੀਂ ਹੁੰਦਾ ਬਾਕੀ ਜੇ ਬਜ਼ੁਰਗ ਜਾਂ ਕੋਈ ਆਪਣੇ ਵਰਗਾ ਇਨਸਾਨ ਨਹੀਂ ਖਾ ਸਕਦਾ ਅਤੇ ਉਹਨੂੰ ਉਬਲਿਆ ਹੀ ਖਾਣਾ ਦੇਣਾ ਚਾਹੀਦਾ ਜਿਹਦੇ ਵਿੱਚ ਲੂਣ ਮਿਰਚ ਮਸਾਲੇ ਘੱਟ ਹੋਣ ਉਹਨੂੰ ਕੋਈ ਵੀ ਤੜਕਾ ਨਾ ਲੱਗਾ ਹੋਵੇ ਤੇਲ ਨਾ ਪਾਇਆ ਹੋਵੇ ਲਸਣ ਪਿਆਜ ਅਦਰਕ ਦੀ ਮਾਤਰਾ ਨਾ ਪਾਈ ਹੋਵੇ ਨਾ ਮਾਤਰ ਹੋਵੇ ਥੋੜ੍ਹਾ ਬਹੁਤਾ ਪਾਇਆ ਹੋਵੇ ਪਰ ਓਹ ਸਭ ਤੋਂ ਜ਼ਿਆਦਾ ਲੂਣ ਔਰ ਮਿਰਚ ਦਾ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਜੇ ਲੂਣ ਮਿਰਚ ਘੱਟ ਆ ਬੀਪੀ ਨਹੀਂ ਵੱਧਦਾ ਪਚਨ 'ਚ ਵੀ ਆਸਾਨੀ ਹੁੰਦੀ ਹੈ ਇਸ ਕਰਕੇ ਮਤਲਬ ਖਾਣਾ ਬਣਾਉਣ ਬਣਾਉਣ ਲਈ ਮਤਲਬ ਕਿ ਬਿਮਾਰ ਬੰਦੇ ਲਈ ਖਾਣਾ ਬਣਾਉਣ ਲਈ ਦਲੀਆ ਓਟਸ ਇੱਦਾਂ ਹੀ ਹਲਕੀਆਂ ਫੁਲਕੀਆਂ ਚੀਜ਼ਾਂ ਦੇ ਦਿਉ ਜਿੰਨਾਂ ਉਹਨੂੰ ਖਾ ਕੇ ਵੀ ਮਤਲਬ ਪਚਿਆ ਵੀ ਰਵੇ ਔਰ ਉਹਨੂੰ ਭਾਰਾਪਨ ਵੀ ਮਹਿਸੂਸ ਨਾ ਹੋਵੇ